ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਾ ਤੁਹਾਡੇ ਕੋਲੋਂ ਕਲਾਈਮੈਕਸ ਕੰਪਨੀ ਦਾ ਪੈੱਨ ਮੰਗਾਇਆ ਸੀਗਾ ਕਾਫੀ ਵਧੀਆ ਪੈੱਨ ਨਿਕਲਿਆ ਉਹ ਅਤੇ ਡਿਲੀਵਰੀ ਵੀ ਟਾਈਮ 'ਤੇ ਆ ਗਈ ਸੀਗੀ ਜਦ ਮੈਨੂੰ ਲੋੜ ਸੀਗੀ ਮੈਂ ਕਿਸੇ ਨੂੰ ਗਿਫਟ ਵੀ ਕਰਨਾ ਸੀ ਹਾਲਾਂਕਿ ਮੈਂ ਤਿੰਨ ਚਾਰ ਪੈੱਨ ਮੰਗਾਏ ਸੀਗੇ ਉਹ 'ਚੋਂ ਮੈਂ ਦੋ ਰੱਖ ਲਏ ਸੀਗੇ ਅਤੇ ਦੋ ਗਿਫਟ ਕਰਤੇ ਸੀ ਅਤੇ ਮੈਂ ਚਾਹੁੰਦਾ ਇੱਦਾਂ ਦੇ ਪੈੱਨ ਮੈਂ ਹੋਰ ਮੰਗਾਵਾਂ ਕਿਉਂਕਿ ਉਹਨਾਂ ਦਾ ਜਿਹੜਾ ਫਲੋ ਸੀਗਾ ਇੰਕ ਦਾ ਉਹ ਬਹੁਤ ਵਧੀਆ ਸੀਗਾ ਅਤੇ ਜਿੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਇਸ ਪੈੱਨ ਦੇ ਨਾਲ ਰਾਈਟਿੰਗ ਆ ਰਹੀ ਹੈ ਉਸ ਕਿਸੇ ਹੋਰ ਪੈੱਨ ਨਾਲ ਨਹੀਂ ਆਈ ਅਤੇ ਮੈਂ ਚਾਹੁੰਦਾ ਕਿ ਤੁਸੀਂ ਕਲਾਈਮੈਕਸ ਕੰਪਨੀ ਦੇ ਇੱਕ ਤਾਂ ਲਾਲ ਰੰਗ ਦੇ ਅਤੇ ਇੱਕ ਹਰੇ ਰੰਗ ਦੀ ਇੰਕ ਵਾਲੇ ਮੈਨੂੰ ਪੈੱਨ ਹੋਰ ਚਾਹੀਦੇ ਨੇ ਅਤੇ ਇਹਨਾਂ ਦਾ ਜਿਹੜਾ ਕਵਰ ਭੇਜੇ ਨਹੀਂ ਇਹ ਲੈਂਥ ਕਵਰ ਕਰਦੇ ਨੇ ਉਹ ਵੀ ਮੈਨੂੰ ਜ਼ਿਆਦਾ ਲੱਗੀ ਕਿਉਂਕਿ ਇਹ ਨੋਰਮਲੀ ਇੱਕ ਪੈੱਨ ਦੇ ਨਾਲ ਕੁਛ ਪੇਜ ਇਹ ਭਰਦੇ ਨੇ ਪਰ ਜਿਹੜਾ ਆਹਾ ਕਲਾਈਮੈਕਸ ਦਾ ਪੈੱਨ ਸੀ ਇਹਦੇ ਨਾਲ ਘੱਟੋ ਘੱਟ ਪੂਰੀ ਇੱਕ ਕਾਪੀ ਭਰ ਗਈ ਹਾਲੇ ਵੀ ਇੰਕ ਪਈ ਹੈ ਇਹਦੇ ਵਿੱਚ ਤਾਂ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਇਹਦੀ ਇੰਕ ਦੀ ਲਾਈਫ ਹੈ ਇਹ ਜ਼ਿਆਦਾ ਹੈ ਅਤੇ ਬਾਕੀ ਫਲੋ ਵੀ ਬਹੁਤ ਵਧੀਆ ਸੀਗਾ ਕਲਰ ਟੈਕਸਚਰ ਵਧੀਆ ਨੇ ਸਾਰੇ ਪੈੱਨ ਦੇ ਇਹ ਗਿਫਟ ਕਰਨ ਯੋਗ ਵੀ ਹੈਗਾ ਅਤੇ ਮੈਂ ਚਾਹੁੰਦਾ ਕੀ ਤੁਸੀਂ ਇਹ ਜਿਹੜਾ ਪੈੱਨ ਮੈਨੂੰ ਸਪਲਾਈ ਕੀਤਾ ਇ ਇੱਦਾਂ ਦੇ ਦਸ ਪੈੱਨ ਹੋਰ ਸਪਲਾਈ ਕਰ ਦਿਓ ਅਤੇ ਮੈਂ ਤੁਹਾਨੂੰ ਹੁਣ ਔਨਲਾਈਨ ਪੇਮੈਂਟ ਭੇਜਣ ਲੱਗਿਆ ਅਤੇ ਨਾਲ ਐਡਰੈੱਸ ਭੇਜ ਦਉਂਗਾ ਮੈਂ ਵੱਟਸਅੱਪ ਕਰ ਦਿੰਦਾ ਐਡਰੈੱਸ ਅਤੇ ਤੁਸੀਂ ਦੇਖ ਲਿਓ ਫਿਰ ਜਲਦੀ ਤੋਂ ਜਲਦੀ ਭੇਜ ਦਿਓ ਕਿਉਂਕਿ ਅੱਗੇ ਇੱਕ ਫੰਕਸ਼ਨ ਹੋਰ ਆ ਰਿਹਾ ਮੈਂ ਸੋਚਦਾ ਆਪਣੇ ਦੋਸਤਾਂ ਮਿੱਤਰਾਂ ਨੂੰ ਉਹੀ ਪੈੱਨ ਗਿਫਟ ਕਰਾਂ